ਬਚਪਨ ਵਿੱਚ ਅਸੀਂ ਬਹੁਤ ਸਾਰੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਜਿਵੇਂ ਕਿ ਬੈਡਮਿੰਟਨ ਕਬੱਡੀ ਖੋ ਖੋ ਪਿੱਠੂ ਗੁੱਲੀ ਡੰਡਾ ਫੜਨ ਫੜੀਚੀ ਬਰਫ ਪਾਣੀ ਲੁਕਣ ਮੀਚੀ ਹੋਰ ਵੀ ਬਹੁਤ ਸਾਰੀਆਂ ਅਸੀਂ ਖੇਡਾਂ ਖੇਡਦੇ ਸੀਗੇ ਟੁੱਟੀ ਚੈਨ ਇਹ ਸਾਰੀਆਂ ਖੇਡਾਂ ਜੁੜੀ ਜ਼ੰਜੀਰ ਅਤੇ ਬੈਡ ਜਦੋਂ ਅਸੀਂ ਪਿੱਠੂ ਖੇਡਦੇ ਹੁੰਦੇ ਸੀ ਪਿੱਠੂ ਮੇਰੀ ਫੇਵਰੇਟ ਜਿਹੜੀ ਗੇਮ ਹੁੰਦੀ ਹੁੰਦੀ ਸੀ ਫੇਵਰੇਟ ਖੇਡ ਹੁੰਦੀ ਹੁੰਦੀ ਸੀ ਇਹਦੇ ਵਿੱਚ ਬਹੁਤ ਸਾਰੇ ਜਾਣੇ ਹੁੰਦੇ ਸੀ ਟੀਮ ਬਣਦੀ ਹੁੰਦੀ ਸੀਗੀ ਅਤੇ ਸੱਤ ਪੱਥਰਾਂ ਨਾਲ ਉਹ ਬਣਾ ਕੇ ਉਹ 'ਤੇ ਬੋਲ ਮਾਰੀ ਜਾਂਦੀ ਸੀ ਫਿਰ ਸਾਰਿਆਂ ਨੂੰ ਫੜਿਆ ਜਾਂਦਾ ਸੀਗਾ ਉਹਨਾਂ ਨਾਲ ਬਾਲ ਮਾਰੀ ਜਾਂਦੀ ਸੀ ਹੋਰ ਅਸੀਂ ਬਾਂਦਰ ਕਿੱਲਾ ਵੀ ਖੇਡਦੇ ਹੁੰਦੇ ਸੀ ਜਿਹਦੇ ਨਾਲ ਕਾਫੀ ਚੱਪਲਾਂ ਪੈਂਦੀਆਂ ਹੁੰਦੀਆਂ ਸੀਗੀਆਂ ਇੱਕ ਦੂਜੇ ਦੇ ਹੋਰ ਅਸੀਂ ਜਿਵੇਂ ਹੁਣ ਗੁੱਲੀ ਡੰਡਾ ਖੇਡਦੇ ਹੁੰਦੇ ਸੀਗੇ ਅਤੇ ਉਹ 'ਚ ਵੀ ਬੜਾ ਮਜ਼ਾ ਆਉਂਦਾ ਹੁੰਦਾ ਸੀ ਸਟੈਪੂ ਹੋ ਗਿਆ ਡਿਕਰੀ ਖਾਨਾ ਜਿਹਦੇ ਨਾਲ ਜਿਹੜੀਆਂ ਸਾਰੀ ਕੁੜੀਆਂ ਮਿਲ ਕੇ ਖੇਡਦੀਆਂ ਹੁੰਦੀਆਂ ਸੀਗੀਆਂ ਅਤੇ ਜਿੰਨੇ ਉਹ ਬੈਡਮਿੰਟਨ ਖੇਡਦੇ ਹੁੰਦੇ ਸੀਗੇ ਹੋਰ ਜਿਵੇਂ ਚਿੜੀ ਬੱਲਾ ਵਗੈਰਾ ਅਤੇ ਹੋਰ ਅਸੀਂ ਬੈਟ ਬੋਲ ਫੜਨ ਫੜੀਚੀ ਅਸੀਂ ਬਹੁਤ ਦਸ ਬਾਰਾਂ ਜਾਣੇ ਹੁੰਦੇ ਸੀ ਅਸੀਂ ਬਹੁਤ ਮਜ਼ਾ ਕਰਦੇ ਹੁੰਦੇ ਸੀਗੇ ਅਤੇ ਅਸੀਂ ਬਰਫ ਪਾਣੀ ਖੇਡਦੇ ਹੁੰਦੇ ਸੀ ਜਦੋਂ ਇਕ ਇੱਕ ਜਣੇ ਦੀ ਵਾਰੀ ਹੁੰਦੀ ਸੀ ਤਾਂ ਜਦੋਂ ਉਹਨੂੰ ਫੜ ਲੈਂਦਾ ਸੀ ਤਾਂ ਉਹ ਬਰਫ ਬਣ ਜਾਂਦਾ ਸੀ ਦੂਜਾ ਬੰਦਾ ਆ ਕੇ ਉਹਨੂੰ ਪਾਣੀ ਕਰਦਾ ਸੀਗਾ ਅਤੇ ਅਸੀਂ ਲੁਕਣ ਮੀਚੀ ਵੀ ਬਹੁਤ ਜ਼ਿਆਦਾ ਖੇਡੀ ਹੈ ਲੁਕਣ ਮੀਚੀ ਵਿੱਚ ਵੀ ਅਸੀਂ ਲੁਕਦੇ ਸੀ ਇੱਕ ਦੂਜੇ ਨੂੰ ਫੜਦੇ ਸੀਗੇ ਸਾਨੂੰ ਬਹੁਤ ਹੀ ਮਜ਼ਾ ਆਉਂਦਾ ਸੀ ਜੁੜੀ ਜ਼ੰਜੀਰ ਅਸੀਂ ਖੇਡਦੇ ਹੁੰਦੇ ਸੀ ਉਹਦੇ ਵਿੱਚ ਜਦੋਂ ਅਸੀਂ ਇੱਕ ਜਣੇ ਨੂੰ ਫੜ ਲੈਂਦੇ ਸੀ ਤਾਂ ਉਹ ਉਹਦੇ ਨਾਲ ਮਿਲ ਕੇ ਫਿਰ ਬਾਕੀ ਸਾਰਿਆਂ ਨੂੰ ਫੜਦਾ ਹੁੰਦਾ ਸੀਗਾ ਅਸੀਂ ਟੁੱਟੀ ਚੈਨ ਵੀ ਖੇਡੀ ਆ ਉਹਦੇ ਵਿੱਚ ਇੱਕ ਜਣਾ ਫੜ ਕੇ ਉਹ ਦੋਨੋਂ ਟੀਮ ਮੈਂਬਰ ਬਣ ਜਾਂਦੇ ਹੁੰਦੇ ਸੀ ਅਤੇ ਉਹ ਇੱਕ ਦੂਜੇ ਨੂੰ ਫੜਦੇ ਹੁੰਦੇ ਸੀ ਫਿਰ ਸਾਨੂੰ ਬਹੁਤ ਮਜ਼ਾ ਆਉਂਦਾ ਸੀ